ਹੈਲੋ ਹਾਂ ਕੀ ਮੈਂ ਕੰਟੀਨ ਵਾਲੀ ਨਾਲ ਗੱਲ ਕਰ ਰਹੀ ਹਾਂ ਤੁਸੀਂ ਕਿਹੜਾ ਓਇਲ ਵਰਤਦੇ ਹੋ ਉਹਦੇ ਵਿੱਚ ਤਾਂ ਬੜੀ ਸਮੈਲ ਆਉਂਦੀ ਹੈ ਤੁਹਾਡੇ ਫ਼ੂਡ 'ਚ ਜੀ ਸਮੋਸੇ ਪੈਟੀਜ਼ ਸਾਰਿਆਂ 'ਚ ਹੀ ਸਮੈਲ ਆ ਰਹੀ ਹੈ ਨਹੀਂ ਨਹੀਂ ਤੁਹਾਡੀ ਕੁਆਲਟੀ ਬਹੁਤ ਬੁਰੀ ਹੈ ਸਮੈਲ ਆਉਂਦੀ ਰਹਿੰਦੀ ਉਹਦੇ ਵਿੱਚੋਂ ਅਤੇ ਇੰਨਾ ਜ਼ਿਆਦਾ ਤੁਸੀਂ ਓਇਲ ਵਰਤ ਰਹੇ ਹੋ ਵੀ ਜਿਹਦੇ ਨਾਲ ਸਾਨੂੰ ਕੈਲੈਸਟ੍ਰੋਲ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਅਤੇ ਖਾਣ 'ਚ ਵੀ ਬਿਲਕੁਲ ਵੀ ਟੇਸਟੀ ਨਹੀਂ ਹੈਗੇ ਤੁਸੀਂ ਫੋਰਚਿਉਨ ਦਾ ਸੋਇਆਬੀਨ ਤੇਲ ਵਰਤ ਸਕਦੇ ਹੋ ਜਿਹੜਾ ਸਭ ਤੋਂ ਵਧੀਆ ਕੁਆਲਟੀ ਦਾ ਹੁੰਦਾ ਅਤੇ ਨਾਲ ਸਫ਼ਾਈ ਵੀ ਵਧੀਆ ਨਹੀਂ ਹੁੰਦੀ ਜਿਹਦੇ ਕਾਰਨ ਸਾਨੂੰ ਬਿਮਾ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੁਹਾਡੀ ਸ਼ੋਪ 'ਤੇ ਬਿਲਕੁਲ ਹਾਈਜੀਨ ਵੀ ਨਹੀਂ ਹੈਗੀ ਨਹੀਂ ਹੁੰਦੀ ਬਹੁਤ ਗੰਦਾ ਹਾਲ ਹੈ ਨਾ ਟੇਬਲ ਸਾਫ਼ ਹੁੰਦੇ ਜਦੋਂ ਕਸਟਮਰ ਆ ਕੇ ਚਲਾ ਜਾਂਦਾ ਤਾਂ ਕੈਂਟੀਨ 'ਤੇ ਉਸ ਤੋਂ ਬਾਅਦ ਵੀ ਪਲੇਟਾਂ ਪਈਆਂ ਰਹਿੰਦੀਆਂ ਨੇ ਟੇਬਲਜ਼ 'ਤੇ ਬਾਕੀ ਕਸਟਮਰ ਨੂੰ ਵੀ ਬਹੁਤ ਪ੍ਰੋਬਲਮ ਹੁੰਦੀਆਂ ਨੇ ਫਿਰ ਉਨ੍ਹਾਂ 'ਤੇ ਆ ਕੇ ਮੱਖੀਆਂ ਬੈਠਦੀਆਂ ਨੇ ਜਿਹਦੇ ਕਾਰਨ ਖਾਣ ਦਾ ਵੀ ਦਿਲ ਨਹੀਂ ਕਰਦਾ ਓੱਥੇ ਬੈਠ ਕੇ ਕਸਟਮਰ ਤਾਂ ਪੂਰਾ ਪੂਰਾ ਧਿਆਨ ਰੱਖਦੇ ਹੀ ਹੈ ਤੁਸੀਂ ਵੀ ਤਾਂ ਮਾੜਾ ਮੋਟਾ ਧਿਆਨ ਦਿਓ ਨਾ ਵੀ ਅਸੀਂ ਸਾਫ਼ ਸਫ਼ਾਈ ਰੱਖੀਏ ਅਤੇ ਨਾ ਤੁਸੀਂ ਗਲਵਜ ਪਾਉਂਦੇ ਹੈ ਸਿਰ 'ਤੇ ਵੀ ਤੁਸੀਂ ਨਹੀਂ ਲੈਂਦੇ ਕੁਛ ਕੱਪੜਾ ਦੁਪੱਟਾ ਜਿਹਦੇ ਕਾਰਨ ਫ਼ੂਡ ਦੇ ਵਿੱਚ ਵਾਲ ਵੀ ਆ ਸਕਦੇ ਨੇ ਵੀ ਮੈਂ ਤੁਹਾ ਜੇ ਇਹ ਹੀ ਹਾਲ ਰਿਹਾ ਤਾਂ ਫਿਰ ਮੈਨੂੰ ਤੁਹਾਡੀ ਕੰਲਪਲੇਂਟ ਫੂਡ ਕੇਅਰ ਵਾਲਿਆਂ ਨੂੰ ਕਰਨੀ ਪੈਣੀ ਹੈ ਹਾਂਜੀ ਮੈਂ ਉਮੀ ਹਾਂਜੀ ਹਾਂਜੀ ਮੈਂ ਉਮੀਦ ਕਰਾਂਗੀ ਕਿ ਤੁਸੀਂ ਮੇਰੀ ਗੱਲ 'ਤੇ ਅਮਲ ਕਰੋਗੇ ਅਤੇ ਅੱਗੇ ਤੋਂ ਵਧੀਆ ਸਫ਼ਾਈ ਅਤੇ ਵਧੀਆ ਕੁਐਂਟੀਟੀ ਵਾਲੀ ਕੁਆਲਟੀ ਵਾਲੀ ਚੀਜ਼ ਵਰਤੋਗੇ ਜਿਹਦੇ ਕਾਰਨ ਕਸਟਮਰ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਹਾਂਜੀ ਮੈਮ ਓਕੇ ਮੈਮ